ਜੇਕਰ ਪ੍ਰੈਸ਼ਰ ਕੁੱਕਰ ਦੀ ਵਰਤੋਂ ਦੀ ਗੱਲ ਕੀਤੀ ਜਾਵੇ ਤਾਂ ਅੱਜ ਕੱਲ ਤਾਂ ਹਰ ਚੀਜ਼ ਕੁੱਕਰ ਵਿੱਚ ਜਲਦੀ ਬਣ ਜਾਂਦੀ ਹਨ ਜੋ ਕਿ ਚੀਜ਼ਾਂ ਅਸੀਂ ਕੜਾਹੀ ਵਿੱਚ ਬਣਾਉਂਦੇ ਸੀ ਅੱਜ ਕੱਲ ਕੁੱਕਰ ਵਿੱਚ ਇੱਕ ਦੋ ਸੀਟੀਆਂ ਵਿੱਚ ਬਣ ਜਾਂਦੀ ਹੈ ਜਿੱਦਾਂ ਜਿੱਦਾਂ ਕਿ ਤੁਸੀਂ ਉਹਦੀ ਆਲੂ ਮਟਰ ਦੀ ਹੀ ਸਬਜ਼ੀ ਲੈ ਲਓ ਉਹਨੂੰ ਅਸੀਂ ਅਗਰ ਕੜਾਹੀ 'ਚ ਬਣਾਈਏ ਤਾਂ ਸਾਨੂੰ ਕਾਫੀ ਸਮੇਂ ਜਾਵੇਗਾ ਅਤੇ ਜੇਕਰ ਅਸੀਂ ਉਹੀ ਸਬਜ਼ੀ ਨੂੰ ਕੁੱਕਰ ਵਿੱਚ ਬਣਾਈਏ ਤਾਂ ਸਾਡੀ ਆ ਹਾਰਡਲੀ ਚਾਰ ਪੰਜ ਸੀਟੀਆਂ ਦੇ ਵਿੱਚ ਸਬਜ਼ੀ ਤਿਆਰ ਹੋ ਜਾਂਦੀ ਹੈ ਹੋਰ ਵੀ ਅਸੀਂ ਕਿਸੇ ਪ੍ਰਕਾਰ ਦੀ ਸਬਜ਼ੀ ਬਣਾਉਣੀ ਕੋਈ ਦਾਲ ਬਣਾਉਣੀ ਹੋਏ ਜਾਂ ਕੋਈ ਸੁੱਕੀ ਸਬਜ਼ੀ ਵੀ ਅੱਜ ਕੱਲ ਤਾਂ ਲੋਕ ਜਲਦੀ ਕੰਮ ਕਰਨ ਲਈ ਹਰ ਚੀਜ਼ ਨੂੰ ਕੁੱਕਰ ਵਿੱਚ ਇੱਕ ਦੋ ਸੀਟੀ ਲਗਵਾਉਂਦੇ ਹਨ ਜਿਸ ਕਰਕੇ ਕਿ ਸਾਡੀ ਚੀਜ਼ ਜਲਦੀ ਤਿਆਰ ਹੋ ਜਾਂਦੀ ਹੈ ਤਾਂ ਕਿ ਸਾਡੇ ਬੱਚੇ ਜਲਦੀ ਖਾ ਸਕਣ ਕਿਉਂਕਿ ਅੱਜ ਕੱਲ ਦੇ ਸਮੇਂ ਵਿੱਚ ਬੱਚਿਆਂ ਨੂੰ ਭੁੱਖ ਬਹੁਤ ਜ਼ਿਆਦਾ ਲੱਗਦੀ ਹੈ ਅਤੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਚੀਜ਼ ਜਲਦੀ ਤਿਆਰ ਹੋ ਜੇ ਅੱਜ ਕੱਲ ਪੋਪਕੋਰਨ ਵਗੈਰਾ ਹੋ ਗਏ ਹਰ ਚੀਜ਼ ਜਿਹੜੀ ਹੈ ਕਿ ਅਸੀਂ ਕੁੱਕਰ ਵਿੱਚ ਦੋ ਮਿੰਟ ਕਰਦੇ ਹਾਂ ਅਤੇ ਸਾਡੀ ਚੀਜ਼ ਬਣ ਕੇ ਤਿਆਰ ਹੋ ਕੇ ਬਾਹਰ ਆ ਜਾਂਦੀ ਹੈ ਅਤੇ ਅਸੀਂ ਆਪਣੇ ਬੱਚਿਆਂ ਨੂੰ ਆਰਾਮ ਨਾਲ ਸਰਵ ਕਰ ਸਕਦੇ ਹਾਂ ਸਾਡੇ ਬੱਚੇ ਖੁਸ਼ੀ ਖੁਸ਼ੀ ਚੀਜ਼ ਖਾਂਦੇ ਹਨ ਹਰ ਚੀਜ਼ ਲਈ ਟਾਈਮ ਜ਼ਰੂਰ ਜਾਂਦਾ ਹੈ ਕੜਾਹੀ ਵਿੱਚ ਪਰ ਕੁੱਕਰ ਵਿੱਚ ਅਸੀਂ ਕਹਿੰਦੇ ਹਾਂ ਕਿ ਕੁੱਕਰ ਇੱਕ ਇਹੋ ਜਿਹੀ ਚੀਜ਼ ਹੈ ਇਹੋ ਜਿਹਾ ਇੱਕ ਬਰਤਨ ਆ ਚੁੱਕਿਆ ਜਿਹਦੇ ਵਿੱਚ ਕਿ ਹਰ ਚੀਜ਼ ਬੜੀ ਆਸਾਨੀ ਨਾਲ ਅਤੇ ਬੜੀ ਜਲਦੀ ਬਣ ਕੇ ਤਿਆਰ ਹੁੰਦੀ ਹੈ ਤਾਂ ਜੋ ਕਿ ਆਉਣ ਵਾਲੇ ਸਮੇਂ ਵਿੱਚ ਵੀ ਸਾਨੂੰ ਕੋਈ ਮੁਸ਼ਕਲ ਨਹੀਂ ਅੱਜ ਕੱਲ ਤਾਂ ਕਈ ਪ੍ਰਕਾਰ ਦੀਆਂ ਚੀਜ਼ਾਂ ਚੱਲ ਚੁੱਕੀਆਂ ਨੇ ਜਿੱਦਾਂ ਪ੍ਰੈਸ਼ਰ ਕੁੱਕਰ ਹੋ ਗਿਆ ਕੁੱਕਰ ਦੇ ਵੀ ਕਈ ਕੁੱਕਰ ਵੀ ਦੋ ਤਿੰਨ ਪ੍ਰਕਾਰ ਦੇ ਹੁੰਦੇ ਹਨ ਜਿਹਦੇ ਵਿੱਚ ਜਿਸ ਬਾਰੇ ਸਾਨੂੰ ਅਜੇ ਤਾਂ ਇੰਨਾ ਨਹੀਂ ਪਤਾ ਪਰ ਜਿਹੜੇ ਜਿਹੜੇ ਕੁੱਕਰ ਸਾਡੇ ਕੋਲ ਅਸੀਂ ਇਸਤੇਮਾਲ ਕਰਦੇ ਹਾਂ ਉਹਦੇ ਵਿੱਚ ਚੀਜ਼ ਬੜੀ ਜਲਦੀ ਬਣਦੀ ਹੈ ਅਤੇ ਅਸੀਂ ਉਹਨੂੰ ਬਣਾ ਕੇ ਜਲਦੀ ਸਰਵ ਕਰ ਲੈਂਦੇ ਆ